ਯੋਗਾ ਦੀਆਂ ਕੁਛ ਪ੍ਰਸਿੱਧ ਸ਼ੈਲੀਆਂ ਹਨ ਜਿਵੇਂ ਕਿ ਹਠ ਯੋਗਾ ਅਲੋਮ ਪਲੋਮ ਯੋਗਾ ਤੜ ਆਸਨ ਆਦਿ ਕਈ ਤਰ੍ਹਾਂ ਦੇ ਹੋਰ ਵੀ ਯੋਗਾ ਹਨ ਜਿਵੇਂ ਕਿ ਮੈਂ ਸੁਬਹਾ ਪੰਜ ਵਜੇ ਉੱਠ ਕੇ ਬਾਬਾ ਰਾਮਦੇਵ ਜੀ ਦਾ ਜੋ ਵੀ ਪ੍ਰੋਗਰਾਮ ਯੋਗਾ ਵਾਲਾ ਆਉਂਦਾ ਹੈ ਉਸ ਨੂੰ ਮੈਂ ਫੋਲੋ ਕਰਦਾ ਹਾਂ ਉਸ ਤਰ੍ਹਾਂ ਦੇ ਬਾਬਾ ਰਾਮਦੇਵ ਜੀ ਕਈ ਤਰ੍ਹਾਂ ਦੇ ਯੋਗਾ ਕਰਾਉਂਦੇ ਹਨ ਮੈਂ ਤਕਰੀਬਨ ਦੋ ਘੰਟੇ ਉਹਨਾਂ ਦਾ ਕਰਾਇਆ ਗਿਆ ਅਭਿਆਸ ਨੂੰ ਰਿਪੀਟ ਕਰਦਾ ਹਾਂ